ਹਰ ਇਨਸਾਨ ਦੀ ਜ਼ਿੰਦਗੀ ਵਿੱਚ ਅਜਿਹਾ ਸਮਾਂ ਆਉਂਦਾ ਹੈ ਜਿਸ ਵਿੱਚ ਉਸਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਰੀ ਜ਼ਿੰਦਗੀ ਵਿੱਚ ਵੀ ਅਜਿਹਾ ਸਮਾਂ ਆਇਆ ਸੀ ਜਦੋਂ ਮੈਂ ਛੋਟਾ ਸੀ ਜਦੋਂ ਮੈਂ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ ਉਸ ਵੇਲੇ ਸਾਡੇ ਘਰ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੋ ਗਈ ਸੀ ਮੇਰੇ ਘਰਦਿਆਂ ਕੋਲ ਫੀਸ ਤੱਕ ਭਰਨ ਦੇ ਪੈਸੇ ਨਹੀਂ ਸਨ ਉਨ੍ਹਾਂ ਨੇ ਮੈਨੂੰ ਸਕੂਲੋਂ ਹਟਾਉਣ ਦਾ ਫੈਸਲਾ ਕਰ ਲਿਆ ਸੀ ਪਰ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਇਸ ਲਈ ਮੈਂ ਕੋਈ ਹੱਲ ਵਸੀਲਾ ਲੱਭ ਕੇ ਆਪਣੇ ਘਰ ਟਿਊਸ਼ਨਾਂ ਪੜ੍ਹਾਉਣੀਆਂ ਸ਼ੁਰੂ ਕੀਤੀਆਂ ਅਤੇ ਆਪਣੇ ਸਕੂਲ ਦੇ ਖਰਚੇ ਅਤੇ ਘਰ ਦੇ ਖਰਚੇ ਕੱਢ ਲਏ ਜਿਸ ਨਾਲ ਘਰਦਿਆਂ ਦਾ ਵੀ ਗੁਜ਼ਾਰਾ ਹੋ ਗਿਆ ਅਤੇ ਮੇਰੇ ਸਕੂਲ ਤੋਂ ਹਟਾਉਣ ਦੀ ਜ਼ਿੱਦ ਵੀ ਉਹਨਾਂ ਦੀ ਪੂਰੀ ਨਾ ਹੋ ਸਕੀ